ਮੇਰਾ ਅੱਜ ਦਾ ਟੋਪਿਕ ਹੈ ਮੋਬਾਈਲ ਫੋਨ ਦੇ ਨੈਗੇਟਿਵ ਵਿਊਜ਼ ਨੈਗੇਟਿਵ ਵਿਊਜ਼ ਕਹਿ ਲਈਏ ਜਾਂ ਫਿਰ ਇਹ ਕਹਿ ਦਈਏ ਕਿ ਇਹਦੇ ਮਾੜੇ ਪ੍ਰਭਾਵ ਕੀ ਨੇ ਹੈ ਨਾ ਨੈਗੇਟਿਵ ਇਫੈਕਟਸ ਤਾਂ ਜਿਹੜਾ ਫੋਨ ਆ ਇਹ ਸਾਨੂੰ ਫਾਇਦੇ ਲਈ ਦਿੱਤਾ ਗਿਆ ਹੈ ਇਹ ਸਾਡੇ ਨਾਲ ਮਤਲਬ ਵਰਦਾਨ ਦੇ ਨਾਲ ਨਾਲ ਸ਼ਰਾਪ ਵੀ ਹੈ ਹੈ ਨਾ ਇਹਦੇ ਫਾਇਦੇ ਇਹ ਆ ਕਿ ਹੈ ਨਾ ਕਿਤੇ ਵੀ ਕ ਆਪਾਂ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਬੈਠੇ ਬੈਠੇ ਦੁਨੀਆਂ ਦੇ ਕਿਸੇ ਵੀ ਕੋਨੇ ਦੀ ਜਾਣਕਾਰੀ ਹਾਸਿਲ ਕਰ ਸਕਦੇ ਹਾਂ ਹੈ ਨਾ ਸੋਸ਼ਲ ਮੀਡੀਆ ਤੇ ਬਹੁਤ ਫਾਇਦੇ ਆ ਪਰ ਬੁਰਾਈ ਵੀ ਆ ਪਰ ਜਿਹੜਾ ਫੋਨ ਆ ਨਾ ਅੱਜ ਕੱਲ੍ਹ ਸ਼ਰਾਪ ਬਣਦਾ ਜਾ ਰਿਹਾ ਕਿਉਂਕਿ ਜਿਹੜੇ ਸਟੂਡੈਂਟਸ ਆ ਜਾਂ ਲੋਕ ਆ ਉਹ ਫੋਨ ਦੀ ਗਲਤ ਵਰਤੋਂ ਕਰਦੇ ਆ ਹੈ ਨਾ ਅਸ਼ਲੀਲ ਵੀਡੀਓਜ਼ ਬਣਾਉਂਦੇ ਆ ਕੁੜੀਆਂ ਦੀਆਂ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਉਹਨਾਂ ਦੇ ਪਿਕਚਰਜ਼ ਕਲਿੱਕ ਕਰਦੇ ਉਹਨਾਂ ਨੂੰ ਗਲਤ ਤਰੀਕੇ ਨਾਲ ਵਾਇਰਲ ਕਰਦੇ ਆ ਬਲੈਕ ਮੇਲਿੰਗ ਕਰਦੇ ਆ ਹੈ ਨਾ ਕੁੜੀਆਂ ਨੂੰ ਬਲੈਕ ਮੇਲ ਕਰਦੇ ਹੈ ਜਾਂ ਫਿਰ ਉਹਨੂੰ ਕਹਿ ਦੇਈਏ ਕਿ ਫੋਨ ਦੇ ਬਹੁਤ ਨੁਕਸਾਨ ਕੀਤੇ ਆ ਹੈ ਨਾ ਦੋ ਦੋ ਤਿੰਨ ਤਿੰਨ ਘੰਟੇ ਲੋਕ ਫੋਨ ਚਲਾਉਂਦੇ ਰਹਿੰਦੇ ਆ ਲਗਾਤਾਰ ਉਹਨਾਂ ਦੀਆਂ ਅੱਖਾਂ ਦਾ ਅੱਖਾਂ ਖਰਾਬ ਹੋ ਗਈਆਂ ਹੈ ਨਾ ਟਾਈਮ ਵੇਸਟ ਹੁੰਦਾ ਪੜਾ ਲ ਬੱਚੇ ਆਪਣੀ ਪੜ੍ਹਾਈ ਛੱਡ ਕੇ ਹੈ ਨਾ ਫੋਨਾਂ ਕਨੀ ਧਿਆਨ ਦਿੰਦੇ ਨੇ ਫੋਨਾਂ ਕਨੀ ਧਿਆਨ ਦਿੰਦੇ ਨੇ ਫੋਨ ਦਾ ਫਾਇਦਾ ਇਹ ਆ ਕਿ ਚਲੋ ਹੈ ਨਾ ਕਿਸੇ ਦੂਰ ਬੈਠੇ ਆ ਕਿਸੇ ਦੂਰ ਰਿਸ਼ਤੇਦਾਰਾਂ ਕੋਲ ਹੈਗੇ ਆ ਉਹਨਾਂ ਦਾ ਹਾਲ ਚਾਲ ਪੁੱਛ ਲਈਏ ਦੁੱਖ ਸੁੱਖ ਸਾਂਝਾ ਕਰ ਲਈਏ ਹੈ ਨਾ ਪਰ ਜਿਹੜੇ ਸਟੂਡੈਂਟਸ ਆ ਜਾਂ ਲੋਕ ਆ ਆਪਣਾ ਵੱਧ ਟਾਈਮ ਸੋਸ਼ਲ ਮੀਡੀਆ 'ਤੇ ਡਿਪੈਂਡ ਕਰਦੇ ਆ ਸਪੈਂਡ ਕਰਦੇ ਆ ਹੈ ਨਾ ਅਤੇ ਹੋਰ ਕੀ ਕਰਦੇ ਆ ਉਹ